ਹੈਲੋ ਸਤਿ ਸ਼੍ਰੀ ਅਕਾਲ ਸਰ ਹਾਂ ਸਰ ਮੈਂ ਨਾ ਤੁਹਾਡੇ ਬੇਟੇ ਦੇ ਸਕੂਲ ਤੋਂ ਬੋਲ ਰਿਹਾ ਹਾਂ ਸਰ ਤੁਹਾਨੂੰ ਬੇਟੇ ਨੇ ਦੱਸਿਆ ਹੋਣਾ ਵਾ ਕਿ ਜਿਹੜਾ ਸਾਡੇ ਸਕੂਲ ਦਾ ਟ੍ਰਿਪ ਹੈ ਇਹ ਨੈਕਸਟ ਮੰਨਥ ਜਾ ਜੀ ਦਸ ਤਰੀਕ ਤੋਂ ਤੁਸੀਂ ਭੇਜ ਰਹੇ ਹੋ ਸਰ ਬੇਟੇ ਨੂੰ ਭੇਜ ਰਹੇ ਹੋ ਸਰ ਬੇਟੇ ਨੂੰ ਅੱਛਾ ਸਰ ਇਹ ਸਾਡਾ ਨਾ ਹਾਂਜੀ ਹਾਂਜੀ ਇਹ ਆਪਾਂ ਦਸ ਤਰੀਕ ਨੂੰ ਜਾ ਰਹੇ ਜੀ ਆਪਣੇ ਸਕੂਲ ਤੋਂ ਅਤੇ ਆਪਾਂ ਬਾਏ ਬੱਸ ਜਾਵਾਂਗੇ ਸਕੂਲ ਦੇ ਅਤੇ ਉੱਥੇ ਜਾ ਕੇ ਸਰ ਬੱਚਿਆਂ ਦੇ ਵਾਸਤੇ ਨਾ ਆਪਾਂ ਉੱਥੇ ਲਾਗੇ ਫਾਈਵ ਸਟਾਰ ਹੋਟਲ ਹੈ ਉਹ ਅਰੇਂਜ ਕੀਤਾ ਹੋਇਆ ਜੀ ਅਤੇ ਉੱਥੇ ਲਾਗੇ ਛਾਗੇ ਜਿੰਨੇ ਵੀ ਬੱਚਿਆਂ ਲਈ ਵੇਖਣ ਵਾਸਤੇ ਹੈਗੇ ਆ ਥਾਂਵਾਂ ਉੱਥੇ ਉਹਨਾਂ ਨੂੰ ਵਿਜ਼ਿਟ ਕਰਾਵਾਂਗੇ ਠੀਕ ਹੈ ਸਰ ਅਤੇ ਤੁਹਾਨੂੰ ਪਤਾ ਹੀ ਆ ਬਈ ਕਿ ਇਹ ਟ੍ਰਿਪ ਸਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਬਈ ਬੱਚੇ ਦੀ ਓਵਰਔਲ ਡਿਵੈਲਪਮੈਂਟ ਦੇ ਵਿੱਚ ਅਤੇ ਇਹ ਇਹਦੇ ਕਲਾਸ ਦੇ ਸਾਰੇ ਬੱਚੇ ਜਾ ਰਹੇ ਸੀਗੇ ਇਹ ਥੋੜ੍ਹਾ ਕਰ ਰਿਹਾ ਸੀ ਕਿ ਮੇਰੇ ਇੱਕ ਵਾਰੀ ਪੇਰੈਂਟਸ ਨਾਲ ਗੱਲ ਕਰੋ ਕੀਤਾ ਅਸੀਂ ਚਲੋ ਸਾਰੇ ਪੇਰੈਂਟਸ ਨੂੰ ਹੀ ਆ ਅਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਬੱਚੇ ਨੂੰ ਜ਼ਰੂਰ ਭੇਜੋ ਸਰ ਅਸੀਂ ਇਹਨਾਂ ਨੂੰ ਮਨਾਲੀ ਲੈ ਕੇ ਜਾ ਰਹੇ ਆ ਜੀ ਅਤੇ ਮਨਾਲੀ ਵਿੱਚ ਉਸ ਵੇਲੇ ਮੌਸਮ ਵੀ ਅੱਛਾ ਹੁੰਦਾ ਇਹ ਸਰ ਤਿੰਨ ਦਿਨ ਦਾ ਹੈ ਜੀ ਟੋਟਲ ਖਰਚਾ ਸਰ ਇਹਦਾ ਅੱਠ ਕੁ ਹਜ਼ਾਰ ਰੁਪਏ ਹੈਗਾ ਜੀ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਸਰ ਬਾਕੀ ਸਾਰਾ ਸਕੂਲ ਜਾ ਰਿਹਾ ਹੈ ਬਟ ਅਸਲ ਇਹ ਗਰੁੱਪ ਦੇ ਵਿੱਚ ਡਿਵਾਈਡ ਕਰਕੇ ਲੈ ਕੇ ਜਾ ਰਹੇ ਆ ਜਿਸ ਗਰੁੱਪ ਦੇ ਵਿੱਚ ਕਹਿ ਲਓ ਕਿ ਮਿਨੀਮਮ ਚਾਲੀ ਕੁ ਬੱਚੇ ਹੈਗੇ ਆ ਅਤੇ ਚਾਲੀ ਤੋਂ ਵੱਧ ਵੀ ਤੁਹਾਨੂੰ ਪਤਾ ਸਰ ਜ਼ਿਆਦੇ ਬੱਚੇ ਲਿਜਾ ਕੇ ਉੱਥੇ ਸਾਂਭਣੇ ਔਖੇ ਹੋ ਜਾਣੇ ਆ ਅਤੇ ਚਲੋ ਠੀਕ ਹੈ ਸਰ ਠੀਕ ਹੈ ਥੈਂਕ ਯੂ ਸਰ ਓ ਓਕੇ ਸਰ ਓਕੇ